ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੇਰਾ ਤਜ਼ਰਬਾ ਖਾਣਾ ਬਣਾਉਣ ਦਾ ਮੈਂ ਸਭ ਤੋਂ ਪਹਿਲਾਂ ਪਲਾਓ ਬਣਾਉਣਾ ਚੌਲ੍ਹਾਂ 'ਚ ਸਬਜ਼ੀਆਂ ਪਾ ਕੇ ਸਿੱਖਆ ਸੀਗਾ ਉਹ ਨਾ ਮੇਰੇ ਤਾਈ ਜੀ ਬੜਾ ਵਧੀਆ ਧਰਦੇ ਹੁੰਦੇ ਅਤੇ ਉਹਨਾਂ ਨੇ ਨਾ ਇੱਕ ਦਿਨ ਧਰੀ ਜਾਣ ਅਤੇ ਉਹ ਕਾਫੀ ਸਾਰੀਆਂ ਸਬਜ਼ੀਆਂ ਜੀ ਕੱਟੀ ਬੈਠੇ ਮੈਂ ਤਾਈ ਜੀ ਨੂੰ ਆਖਿਆ ਮੈਂ ਕਿਹਾ ਤਾਈ ਜੀ ਤੁਸੀਂ ਕੀ ਬਣਾ ਰਹੇ ਹੋ ਉਹ ਕਹਿੰਦੇ ਪੁੱਤ ਮੈਂ ਚੌਲ੍ਹਾਂ 'ਚ ਸਬਜ਼ੀਆਂ ਪਾ ਕੇ ਪਲਾਓ ਬਣਾਉਂਦੀ ਹਾਂ ਤੂੰ ਖਾਣਾ ਅਤੇ ਮੈਂ ਖਾਧਾ ਮੈਨੂੰ ਬੜਾ ਸਵਾਦ ਲੱਗਿਆ ਫਿਰ ਮੈਂ ਇੱਕ ਦੂਜੇ ਦਿਨ ਤਾਈ ਜੀ ਨੂੰ ਕਿਹਾ ਮੈਂ ਹਾਂ ਮੈਨੂੰ ਇਹ ਸਿਖਾ ਦਿਓ ਅਤੇ ਚਲੋ ਉਹਨਾਂ ਨੇ ਮੈਨੂੰ ਸਿਖਾਇਆ ਅਤੇ ਮੈਂ ਫਿਰ ਆਪਣੇ ਘਰ ਜਿਹੜਾ ਆ ਕੇ ਮੰਮੀ ਹੋਰਾਂ ਨੂੰ ਕਿਹਾ ਅਤੇ ਦਾਦਾ ਜੀ ਨੂੰ ਕਿਹਾ ਮੈਂ ਤੁਹਾਨੂੰ ਅੱਜ ਚੌਲ੍ਹਾਂ ਦਾ ਪਲਾਓ ਬਣਾ ਕੇ ਖਵਾਉਣੀ ਆ ਕਹਿੰਦੇ ਚਲੋ ਖਵਾਓ ਅਤੇ ਸਾਰੇ ਬੜੇ ਖੁਸ਼ ਵੀ ਮੈਂ ਲਾਈਫ 'ਚ ਪਹਿਲੀ ਵਾਰ ਰਸੋਈ 'ਚ ਵੜੀ ਸੀ ਅਤੇ ਮੰਮੀ ਬਹੁਤ ਡਰੇ ਹੋਏ ਸੀ ਵੀ ਇਹ ਕੁਛ ਨਾ ਕੁਛ ਖਰਾਬ ਕਰੇਗੀ ਅਤੇ ਫਿਰ ਮੈਂ ਪਰ ਮੈਂ ਸੀਟੀਆਂ ਵੱਧ ਮਰਵਾ ਕੇ ਅਤੇ ਉਹ ਸਾਰਾ ਮਚਾ ਤਾ ਸੀ ਅਤੇ ਫਿਰ ਮੇਰੇ ਗਾਲ੍ਹਾਂ ਵੀ ਬਹੁਤ ਪਈਆਂ ਸੀ ਤੈਨੂੰ ਕਿਹਾ ਸੀ ਮੈਂ ਧਰ ਦਿੰਦੀ ਹਾਂ ਬਟ ਮੈਂ ਮਚਾ ਤਾ ਸੀ ਉਹ ਫਿਰ ਮੈਂ ਹੌਲੀ ਹੌਲੀ ਇੱਕ ਦੋ ਦਿਨਾਂ 'ਚ ਨਾ ਉਹ ਸਿੱਖ ਗਈ ਸੀ ਅਤੇ ਮੈਂ ਬਹੁਤ ਵਧੀਆ ਬਣਾਉਣ ਲੱਗ ਗਈ ਸੀ ਅਤੇ ਹੁਣ ਵੀ ਮੈਂ ਉਹਨੂੰ ਬਹੁਤ ਛੇਤੀ ਉਹ ਸਿੱਖ ਜਾਂਦੀ ਹਾਂ ਅਤੇ ਮੈਨੂੰ ਮੇਰੀ ਫੇਵਰੇਟ ਡਿਸ਼ ਵੀ ਉਹੀ ਚਲਦੀ ਹੁੰਦੀ ਵੀ ਮੈਨੂੰ ਪਲਾਓ ਬਣਾਉਣ 'ਚ ਬੜਾ ਮਜ਼ਾ ਆਉਂਦਾ ਅਤੇ ਮੈਂ ਗਰਮੀਆਂ 'ਚ ਬਹੁਤ ਖਾਂਦੀ ਹਾਂ ਜੇ ਕੁਛ ਨਾ ਬਣੇ ਨਾ ਮੈਂ ਕਹਿ ਦਿੰਦੀ ਹਾਂ ਪਲਾਓ ਬਣਾ ਲੈਂਦੀ ਹਾਂ ਅੱਜ ਓਕੇ ਥੈਂਕ ਊ ਜੀ